ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪਕ ਬਾਸੁ ਹੈ ਜੀ ਬਿਲਕੁਲ ਮੇਰਾ ਸਵਾਲ ਜਿੱਦਾਂ ਹੈਗਾ ਕੀ ਤੁਸੀਂ ਮੌਸਮ ਹੋ ਕੀੜੇ ਮਕੌੜਿਆਂ ਵਿੱਚ ਹੋਰ ਕਾਰਕਾ ਵਿੱਚ ਤਬਦੀਲੀ ਨੂੰ ਅਨਕੂਲ ਕਿਵੇਂ ਹੋ ਸਕਦੇ ਓ ਉਹਦਾ ਜਵਾਬ ਹੈ ਜੀ ਕੀ ਸਾਡੀਆਂ ਫਸਲਾਂ ਤੇ ਕਾਫੀ ਪ੍ਰਭਾਵ ਪੈਂਦਾ ਕੀੜੇ ਮਕੌੜਿਆਂ ਦਾ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਉਸ ਤਰ੍ਹਾਂ ਜਮੀਨ ਚੋਂ ਬਾਹਰ ਆਉਂਦੇ ਆ ਤੇ ਆ ਕੇ ਇਹ ਸਾਡੀਆਂ ਫਸਲਾਂ ਜਦੋਂ ਪੱਕ ਜਾਂਦੀਆਂ ਸਾਰੀਆਂ ਇਹ ਕੀੜੇ ਜਦੋਂ ਲੱਗ ਜਾਂਦੇ ਉਹਨਾਂ ਨੂੰ ਤੇ ਸਾਰੀਆਂ ਫਸਲਾਂ ਖਰਾਬ ਕਰ ਦਿੰਦੇ ਆ ਸਾਰੀ ਕੀਤੇ ਕਰਾਏ ਤੇ ਪਾਣੀ ਫੇਰ ਦਿੰਦੇ ਆ ਐਨੀ ਮਿਹਨਤ ਦੇ ਨਾਲ ਕਿਸਾਨ ਵਿਚਾਰਾ ਬੀਜ ਲੈ ਕੇ ਆਉਂਦਾ ਖਾਦਾਂ ਲੈ ਕੇ ਆਉਂਦਾ ਫਸਲਾਂ ਨੂੰ ਉਗਾਉਂਦਾ ਪਾਣੀ ਲਾਉਂਦਾ ਗਰਮੀ ਨੀ ਵੇਖਦਾ ਠੰਡ ਨੀ ਵੇਖਦਾ ਤੇ ਅਗਲੇ ਦੀ ਸਾਰੀ ਕੀਤੀ ਕਰਾਈ ਇੱਕ ਮਿੱਟੀ ਕਰ ਦਿੰਦੇ ਆ ਇਹ ਕੀੜੇ ਜਿਹੜੇ ਆ ਇਹਨਾਂ ਨੇ ਜਦੋਂ ਪਤਾ ਨਹੀਂ ਇਹਨਾਂ ਨੂੰ ਖਰੇ ਕੀ ਫਸਲਾਂ ਨਾਲ ਵੈਰ ਹੈਗਾ ਕਿ ਫਸਲਾਂ ਨੂੰ ਲੱਗ ਕੇ ਫਸਲਾਂ ਨੂੰ ਖਰਾਬ ਕਰਕੇ ਸੁੱਟੀ ਜਾਂਦੇ ਆ ਅੱਗੇ ਕਿਸਾਨ ਦਾ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਤੇ ਆਮ ਜਨਤਾ ਉਤੇ ਇਹਦਾ ਪ੍ਰਭਾਵ ਪੈਂਦਾ ਜਦੋਂ ਕੋਈ ਫਸਲ ਖਰਾਬ ਹੁੰਦੀ ਆ ਤੇ ਨੈਚੁਰਲੀ ਗੱਲ ਆ ਜੀ ਜਿਹੜੀ ਹੈਗੀ ਆ ਕੀਮਤ ਵੱਧ ਜਾਣੀ ਆ ਕੁਆਲਿਟੀ ਘੱਟ ਜਾਣੀ ਆ ਉਹਦੀ ਜਿਹੜਾ ਉਹਦੀ ਹੈਗੀ ਆ ਘੱਟ ਜਾਣੀ ਆ ਤੇ ਉਹ ਫਿਰ ਉਸ ਹਿਸਾਬ ਨਾਲ ਮਹਿੰਗੀ ਆਮ ਲੋਕਾਂ 'ਤੇ ਵਰਦੀ ਆ ਤੇ ਦੇਖੋ ਜੀ ਕਿਸਾਨ ਜਿਹੜੀ ਫਸਲ ਲਾਉਂਦਾ ਵੇਚਣ ਵਾਸਤੇ ਲਾਉਂਦਾ ਉਹਦਾ ਜਿਹੜਾ ਘਰ ਦਾ ਗੁਜ਼ਾਰਾ ਉਸ ਫਸਲ ਦੇ ਪੈਸਿਆਂ ਨਾਲ ਚੱਲਣਾ ਤੇ ਆਮ ਲੋਕਾਂ ਉੱਤੇ ਇਹਦਾ ਜਿਆਦਾ ਪ੍ਰਭਾਵ ਪੈ ਜਾਂਦਾ ਫਸਲਾਂ ਦਾ ਜਦੋਂ ਕੀੜੇ ਲੱਗ ਜਾਂਦੇ ਇਹਨਾਂ ਨੂੰ ਉਹ ਫਿਰ ਉਨੀ ਫਸਲ ਹੁੰਦੀ ਨਹੀਂ ਆ ਜਿੰਨੀ ਹੋਣੀ ਚਾਹੀਦੀ ਆ ਫਿਰ ਉਹਦੀ ਕੀਮਤ ਵੱਧ ਲੱਗਦੀ ਆ ਉਹ ਕੀਮਤ ਵੱਧ ਲੱਗਣ ਨਾਲ ਕਿਸਾਨ ਨੂੰ ਵੀ ਘੱਟਾ ਤੇ ਆਮ ਜਨਤਾ ਨੂੰ ਵੀ ਘਾਟਾ ਧੰਨਵਾਦ ਜੀ